ਪੰਜਾਬ ਵਿੱਚ ਕਈ ਪ੍ਰਕਾਰ ਦੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਜਿਵੇਂ ਕਿ ਟੈਨਿਸ ਅਨੁਰਾਣੀ ਕ੍ਰਿਕਟ ਵਾਲੀਬਾਲ ਬਾਸਕਿਟਬਾਲ ਇਹਨਾਂ ਸਾਰੀਆਂ ਖੇਡਾਂ ਨੂੰ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ 'ਤੇ ਵੀ ਖੇਡਿਆ ਜਾਂਦਾ ਹੈ ਇਹ ਅੱਜ ਕੱਲ ਹਰ ਇੱਕ ਖੇਡ ਪਿੰਡ ਪਿੰਡ ਸ਼ਹਿਰ ਸ਼ਹਿਰ ਵਿੱਚ ਮਸ਼ਹੂਰ ਹੈ ਜੇਕਰ ਅਸੀਂ ਗੱਲ ਕਰੀਏ ਕਬੱਡੀ ਦੀ ਜਾਂ ਕ੍ਰਿਕਟ ਦੀ ਕ ਇਹ ਦੋਵੇਂ ਚੀਜ਼ਾਂ ਬਹੁਤ ਹੀ ਮਸ਼ਹੂਰ ਹਨ ਪਿੰਡਾਂ 'ਚ ਵੀ ਅਤੇ ਸ਼ਹਿਰਾਂ 'ਚ ਵੀ ਬਾਕੀ ਗੱਲ ਜੇਕਰ ਮਨਪਸੰਦ ਖੇਡ ਦੀ ਗੱਲ ਕੀਤੀ ਜਾਵੇ ਮਨਪਸੰਦ ਖੇਡ ਬੱਚਿਆਂ ਦੀ ਤਾਂ ਹਮੇਸ਼ਾ ਹੀ ਕ੍ਰਿਕਟ ਹੁੰਦੀ ਹੈ ਕ੍ਰਿਕਟ ਦੇ ਵਿੱਚ ਗਿਆਰਾਂ ਗਿਆਰਾਂ ਪਲੇਅਰ ਹੁੰਦੇ ਆ ਕ੍ਰਿਕਟ ਇੱਕ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ 'ਤੇ ਖੇਡਣ ਜਾਣ ਵਾਲੀ ਖੇਡ ਹੈ ਇਸ ਨੂੰ ਦ ਖੁੱਲ੍ਹੇ ਮੈਦਾਨ ਵਿੱਚ ਖੇਡਿਆ ਜਾਂਦਾ ਹੈ ਕ੍ਰਿਕਟ ਨੂੰ ਦੋ ਟੀਮਾਂ ਵਿੱਚ ਖੇਡਿਆ ਜਾਂਦਾ ਹੈ ਹਰ ਇੱਕ ਟੀਮ ਵਿੱਚ ਗਿਆਰਾਂ ਗਿਆਰਾਂ ਖਿਡਾਰੀ ਹੁੰਦੇ ਹਨ ਇਸ ਨੂੰ ਖੇਡਣ ਲਈ ਬੱਲੇ ਅਤੇ ਗੇਂਦ ਦੀ ਜ਼ਰੂਰਤ ਹੁੰਦੀ ਹੈ ਕ੍ਰਿਕਟ ਖੇਡ ਵਿੱਚ ਕਈ ਤਰ੍ਹਾਂ ਦੇ ਮੈਚ ਹੁੰਦੇ ਹਨ ਜਿਵੇਂ ਕਿ ਇੱਕ ਦਿਨ ਦਾ ਮੈਚ ਜਿਹਨੂੰ ਆਪਾਂ ਵੰਨ ਡੇ ਵੀ ਕਹਿੰਦੇ ਹਾਂ ਟੈਸਟ ਮੈਚ ਜੋ ਕਿ ਤਿੰਨ ਤੋਂ ਪੰਜ ਦਿਨ ਲਈ ਚੱਲਦਾ ਹੈ ਟਵੈਂਟੀ ਟਵੈਂਟੀ ਮੈਚ ਟਵੈਂਟੀ ਟਵੈਂਟੀ ਮੈਚ ਮੀਨ ਵੀਹ ਓਵਰਾਂ ਦਾ ਮੈਚ ਇਹਦੇ ਵਿੱਚ ਕੁੱਲ ਇੱਕ ਸੌ ਵੀਹ ਗੇਂਦਾਂ ਹੁੰਦੀਆਂ ਜੇਕਰ ਅਸੀਂ ਇੱਕ ਦਿਨ ਦੇ ਮੈਚ ਦੀ ਗੱਲ ਕਰੀਏ ਇਹਦੇ ਵਿੱਚ ਕੁੱਲ ਤਿੰਨ ਸੌ ਬਾਲਾਂ ਹੁੰਦੀਆਂ ਨੇ ਹੁੰਦੀਆਂ ਹਨ ਜਿਹਨੂੰ ਆਪਾਂ ਖੇਡਣਾ ਹੁੰਦਾ ਹੈ ਅਤੇ ਜਿਹੜਾ ਵੱਧ ਤੋਂ ਵੱਧ ਸਕੋਰ ਕਰਦਾ ਹੈ ਉਹ ਟੀਮ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈ ਟੈਸਟ ਮੈਚ ਦੀ ਇਹ ਗੱਲ ਹੁੰਦੀ ਹੈ ਇਹਦੇ ਵਿੱਚ ਸਾਨੂੰ ਇੱਕ ਦਿਨ ਵਿੱਚ ਨੱਬੇ ਓਵਰ ਮਿਲਦੇ ਹਨ ਯਾਨੀ ਕਿ ਖੁੱਲ੍ਹੀਆਂ ਬਾਲਾਂ ਹੁੰਦੀਆਂ ਨੇ ਇਹਦੇ ਵਿੱਚ ਅਸੀਂ ਖੇਡਣੀਆਂ ਹੁੰਦੀਆਂ ਨੇ ਜੋ ਜਿਹੜੀ ਟੀਮ ਵੱਧ ਤੋਂ ਵੱਧ ਸਕੋਰ ਕਰਦੀ ਹੈ ਉਸ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈ ਟਵੈਂਟੀ ਟਵੈਂਟੀ ਵਿੱਚ ਕੁੱਲ ਇੱਕ ਸੌ ਵੀਹ ਬਾਲਾਂ ਹੁੰਦੀਆਂ ਨੇ ਜਿਹਦੇ ਵਿੱਚ ਸਾਨੂੰ ਵੱਧ ਤੋਂ ਵੱਧ ਸਕੋਰ ਕਰਕੇ ਜੇਤੂ ਟੀਮ ਦਾ ਨਾਮ ਲੈਣਾ ਚਾਹੀਦਾ ਹੈ ਕ੍ਰਿਕਟ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਬ੍ਰਿਟੇਨ ਵਿੱਚ ਹੋਈ ਸੀ ਕ੍ਰਿਕਟ ਇੱਕ ਬਾਹਰ ਦੀ ਖੇਡ ਹੈ ਜਿਸ ਦੀ ਸ਼ੁਰੂਆਤ ਬਾਹਰਲੇ ਮੁਲਕ ਵਿੱਚ ਹੋਈ ਸੀ ਬ੍ਰਿਟੇਨ 'ਚ ਮੇਰਾ ਪਸੰਦੀਦਾ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਹੈ ਯੁਵਰਾਜ ਸਿੰਘ ਇਸ ਲਈ ਹੈ ਕਿਉਂਕਿ ਇਹ ਬੜੇ ਲਗਨ ਦੇ ਨਾਲ ਖੇਡਦਾ ਹੈ ਸਭ ਤੋਂ ਵੱਧ ਸਕੋਰ ਇਸ ਦੇ ਨਾਮ ਹਨ ਇਹ ਬਹੁਤ ਹੀ ਵਧੀਆ ਪਲੇਅਰ ਹੈ ਜੋ ਕਿ ਪੂਰੀ ਹਾਰਡ ਵਰਕਿੰਗ ਅਤੇ ਮਿਹਨਤ ਨਾਲ ਖੇਡਦਾ ਹੈ ਇਸ ਵਿੱਚ ਇਹ ਕਪ ਇਹ ਕਪਟੀ ਵੀ ਨਹੀਂ ਹੈ ਇਹ ਹਰ ਇੱਕ ਟੀਮ ਮੈਂਬਰ ਨੂੰ ਪਿਆਰ ਨਾਲ ਬੁਲਾਉਂਦਾ ਹੈ ਹਰ ਇੱਕ ਨੂੰ ਆਪਸੀ ਭਾਈਚਾਰੇ ਦਾ ਪਿਆਰ ਦਿੰਦਾ ਹੈ ਜੋ ਟੀਮ 'ਚ ਜੋ ਟੀਮ ਮੈਨੂੰ ਬਹੁਤ ਪਸੰਦ ਲੱਗਦੀ ਆ ਉਹ ਹੈ ਇੰਗਲੈਂਡ ਇੰਗਲੈਂਡ ਦੀ ਟੀਮ ਬਹੁਤ ਹੀ ਵਧੀਆ ਹੈ ਜੋ ਕਿ ਹਰ ਇੱਕ ਸਿਚੁਏਸ਼ਨ ਨੂੰ ਟੈਕਲ ਕਰਨਾ ਜਾਣਦੀ ਹੈ ਹ ਬਹੁਤ ਹੀ ਵਧੀਆ ਖੇਡਦੇ ਹਨ ਮੈਨੂੰ ਬਹੁਤ ਹੀ ਪਸੰਦ ਹੈ ਕ੍ਰਿਕਟ ਮੈਨੂੰ ਬਲੀ ਬ ਬੱਲੇਬਾਜ਼ੀ ਕਰਨਾ ਵੀ ਬਹੁਤ ਪਸੰਦ ਹੈ ਜੋ ਕਿ ਮੈਂ ਕਰਨਾ ਚਾਹੁੰਦਾ ਹਾਂ ਅਤੇ ਕ੍ਰਿਕਟਰ ਬਣਨਾ ਚਾਹੁੰਦਾ